ਭੰਗੜਾ ਐਰੋਬਿਕਸ ਵਿੱਚ ਹਿੱਸਾ ਲੈਣ ਨਾਲ ਸਰੀਰਕ ਅਤੇ ਮਾਨਸਿਕ ਤੌਰ ਤੇ ਬਹੁਤ ਸਾਰੇ ਫਾਇਦੇ ਹੋ ਸਕਦੇ ਹਨ ਜਿਵੇਂ ਕਿ ਸਰੀਰਕ ਤੌਰ ਤੇ ਫਾਇਦੇ ਮਜਬੂਤੀ ਅਤੇ ਫਿਟਨੈਸ ਭੰਗੜਾ ਐਰੋਬਿਕਸ ਇੱਕ ਐਕਸਰਸਾਈਜ ਹੈ ਜੋ ਦਿਲ ਦੀ ਸਿਹਤ ਸਹਿਣਸ਼ੀਲਤਾ ਅਤੇ ਸਰੀਰ ਦੀ ਮਜਬੂਤੀ ਨੂੰ ਸੁਧਾਰਦਾ ਹੈ ਕੈਲਰੀ ਬਰਨਿੰਗ ਇਸ ਨਾਲ ਸਰੀਰ ਵਿੱਚ ਕੈਲਰੀ ਨੂੰ ਜਲਾਉਣ ਵਿੱਚ ਮਦਦ ਮਿਲਦੀ ਹੈ ਜਿਸ ਨਾਲ ਵੱਜਨ ਘਟਾਉਣਾ ਆਸਾਨ ਹੁੰਦਾ ਹੈ ਲਚੀਲਾਪਣ ਵਿੱਚ ਸੁਧਾਰ ਭੰਗੜਾ ਦੇ ਟੈਂਟਾਂ ਅਤੇ ਮੂਵਮੈਂਟ ਸਰੀਰ ਦੀ ਲਚੀਲਾਪਣ ਨੂੰ ਵਧਾਉਂਦੇ ਹਨ ਮਾਨਸਿਕ ਤੌਰ ਦੇ ਫਾਇਦੇ ਮਨੋ ਮਨੋਰੰਜਨ ਅਤੇ ਖੁਸ਼ੀ ਭੰਗੜਾ ਐਰੋਬਿਕਸ ਵਿੱਚ ਹਿੱਸਾ ਲੈਣ ਨਾਲ ਮਨੋਰੰਜਨ ਅਤੇ ਖੁਸ਼ੀ ਮਿਲਦੀ ਹੈ ਕਿਉਂਕਿ ਇਸ ਨੂੰ ਕਰਦੇ ਹੋਏ ਮਿਊਜਿਕ ਅਤੇ ਡਾਂਸ ਦੀ ਮਜਾ ਮਿਲਦੀ ਹੈ ਤਣਾਅ ਘਟਾਉਣਾ ਜਦੋਂ ਤੁਸੀਂ ਨਚਦੇ ਹੋ ਤਾਂ ਮਨ ਹਲਕਾ ਹੁੰਦਾ ਹੈ ਅਤੇ ਤਣਾਅ ਘੱਟਦਾ ਹੈ ਜੋ ਮਾਨਸਿਕ ਤੰਦਰੁਸਤੀ ਲਈ ਫਾਇਦੇਮੰਦ ਹੈ ਆਤਮ ਵਿਸ਼ਵਾਸ ਵਿੱਚ ਵਾਧਾ ਨੱਚਣ ਨਾਲ ਆਪਣੇ ਆਪ ਨੂੰ ਪ੍ਰਗਟ ਕਰਨ ਅਤੇ ਸਥਿਤੀ ਨੂੰ ਹੱਲ ਕਰਨ ਵਿੱਚ ਆਤਮ ਵਿਸ਼ਵਾਸ ਵਧਦਾ ਹੈ ਇਹ ਸਾਰੀਆਂ ਗੱਲਾਂ ਮਿਲ ਕੇ ਭੰਗੜਾ ਐਰੋਬਿਕਸ ਨੂੰ ਇੱਕ ਬਹੁਤ ਹੀ ਲਾਭਦਾਇਕ ਤੇ ਮਨੋਰੰਜਕ ਐਕਸਰਸਾਈਜ਼ ਬਣਾਉਂਦੀਆਂ ਹਨ